ਹਾਂਜੀ ਭਾਅ ਜੀ ਹੋਰ ਕੀ ਹਾਲ ਜੇ ਅੱਛਾ ਤੁਸੀਂ ਮੈਨੂੰ ਭੁਗਤਾਨ ਕਰਨ ਲਈ ਕਹਿ ਰਹੇ ਹੋ ਅਤੇ ਮੇਰੇ ਕੋਲ ਤਾਂ ਵੀਰ ਜੀ ਆਪਣਾ ਕੈਸ਼ ਹੀ ਹੈਗਾ ਜੇ

ਨਹੀਂ ਭਾਅ ਜੀ ਤੁਸੀਂ ਮੈਨੂੰ ਦੇਖੋ ਤੁਸੀਂ ਮੈਨੂੰ ਬੁੱਕ ਕਰਨ ਤੋਂ ਪਹਿਲਾਂ ਮੈਨੂੰ ਦੱਸ ਤਾਂ ਦਿੰਦੇ ਕਿ ਤੁਹਾਨੂੰ ਔਨਲਾਈਨ ਚਾਹੀਦੇ ਆ ਮੇਰੇ ਕੋਲ ਤਾਂ ਵੀਰ ਜੀ ਔਨਲਾਈਨ ਨਹੀਂ ਹੈਗੇ ਮੈਂ ਤਾਂ ਕੈਸ਼ ਆ ਮੇਰੇ ਕੋਲੋਂ ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਔਨਲਾਈਨ ਨਹੀਂ ਲੈਣੇ ਮੈਂ ਫਿਰ ਕੋਈ ਅਰੇਂਜਮੈਂਟ ਕਰਕੇ ਆਉਂਦਾ ਜਾਂ ਆਪਣਾ ਕ੍ਰੈਡਿਟ ਕਾਰਡ ਆਪਣਾ ਲੈ ਕੇ ਆਉਂਦਾ ਕੋਈ ਏ ਟੀ ਐਮ ਕਾਰਡ ਲੈ ਆਉਂਦਾ ਅਤੇ ਭਾਅ ਜੀ ਹੁਣ ਤਾਂ ਮੇਰੇ ਕੋਲ ਕੈਸ਼ ਹੈਗਾ ਏ ਤਾਂ ਨਾਲੇ ਇਹ ਚੀਜ਼ ਕਦੋਂ ਦੀ ਬਦਲੀ ਹੋਈ ਹੈ ਕਿ ਮੈਂ ਮ ਮਤਲਬ ਕਿ ਔਨਲਾਈਨ ਹੀ ਲੈ ਕੇ ਆ ਸਕਦਾ ਹੁਣ ਭਾਅ ਜੀ ਮੇਰੇ ਕੋਲ ਜਿਹੜੀ ਸਹੂਲਤ ਹੈਗੀ ਆ ਜੋ ਚੀਜ਼ ਮੇਰੇ ਕੋਲ ਇਸ ਟਾਈਮ ਮੌਜੂਦ ਆ ਮੈਂ ਉਹਦੇ ਤੋਂ ਝੂਠ ਥੋੜ੍ਹੀ ਤੁਹਾਨੂੰ ਕਹਿ ਰਿਹਾਂ ਓਕੇ ਜੀ